ਪੰਜਾਬ ਨੂੰ ਮੇਲਿਆਂ ਦਾ ਦੇਸ਼ ਕਿਹਾ ਜਾਂਦਾ ਹੈ ਇਸ ਵਿੱਚ ਕਈ ਤਰ੍ਹਾਂ ਦੇ ਇਤਿਹਾਸਿਕ ਮੇਲੇ ਜੋੜ ਮੇਲੇ ਆਦਿ ਪ੍ਰਕਾਰ ਦੇ ਮੇਲੇ ਲੱਗਦੇ ਹਨ ਸਾਡੇ ਪੰਜਾਬ ਦਾ ਖਾਸ ਤਿਉਹਾਰ ਲੋਹੜੀ ਦਾ ਤਿਉਹਾਰ ਹੈ ਇਸ ਤਿਉਹਾਰ ਨੂੰ ਬੜੀ ਹੀ ਧੂਮ ਧਾਮ ਨਾਲ ਪੂਰੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਇਸ ਤਿਉਹਾਰ 'ਤੇ ਕਾਫੀ ਮੇਲੇ ਲੱਗਦੇ ਹਨ ਸਾਡੇ ਪੰਜਾਬ ਵਿੱਚ ਖਾਸ ਕਰਕੇ ਮੁਕਤਸਰ ਦਾ ਮੇਲਾ ਜਗਰਾਉਂ ਦਾ ਮੇਲਾ ਛਪਾਰ ਦਾ ਮੇਲਾ ਹੋਲੇ ਮਹੱਲੇ ਦਾ ਮੇਲਾ ਵਿਸਾਖੀ ਦਾ ਮੇਲਾ ਆਦਿ ਪ੍ਰਸਿੱਧ ਮੇਲੇ ਹਨ ਇਹਨਾਂ ਵਿੱਚੋਂ ਕਈ ਮੇਲੇ ਇਤਿਹਾਸਿਕ ਪਿਛੋਕੜ ਨਾਲ ਸੰਬੰਧਿਤ ਕਾਰਨਾਂ ਕਰਕੇ ਲੱਗਦੇ ਹਨ ਅਤੇ ਕਈ ਖੁਸ਼ੀ ਦੇ ਪ੍ਰਗਟਾਵੇ ਲਈ ਸਾਡੇ ਖੇਤਰ ਵਿੱਚ ਮੁਕਤਸਰ ਦਾ ਮਾਘੀ ਦਾ ਮੇਲਾ ਬਹੁਤ ਹੀ ਪ੍ਰਸਿੱਧ ਹੈ ਜਿਸ ਨੂੰ ਮੁਕਤਸਰ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਹ ਮੇਲਾ ਹਰ ਸਾਲ ਜਨਵਰੀ ਮਹੀਨੇ ਵਿੱਚ ਮਾਘ ਦੇ ਮਹੀਨੇ ਵਿੱਚ ਲੱਗਦਾ ਹੈ ਇਹ ਮੇਲਾ ਸਤਾਰ੍ਹਾਂ ਸੌ ਪੰਜ ਈਸਵੀਂ ਵਿੱਚ ਹੋਈ ਖਿਦਰਾਨੇ ਦੀ ਲੜਾਈ ਵਿੱਚ ਮੁਗਲਾਂ ਨੇ ਲ਼ੜਦੇ ਹੋਏ ਚਾਲ੍ਹੀ ਸਿੱਖ ਯੋਧੇ ਸ਼ਹੀਦ ਹੋਏ ਹਨ ਉਹਨਾਂ ਦੀ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਉਸ ਯੁੱਧ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਖਿਦਰਾਨੇ ਤੋ ਬਦਲ ਕੇ ਮੁਕਤੀ ਦਾ ਪੁੱਲ ਮੁਕਤਸਰ ਰੱਖ ਦਿੱਤਾ ਗਿਆ ਜਿਸ ਨੂੰ ਅੱਜ ਆਦਰ ਅਤੇ ਸਮਾਨ ਨਾਲ ਸ਼੍ਰੀ ਮੁਕਤਸਰ ਸਾਹਿਬ ਨਾਲ ਜਾਣਿਆ ਜਾਂਦਾ ਹੈ